ਹਾਂਜੀ ਅੱਜ ਦੀ ਦੁਨੀਆ ਅੱਜ ਦੇ ਸੰਸਾਰ ਵਿੱਚ ਸਾਰੇ ਹੀ ਕੰਮ ਤਕਨੀਕੀ ਹੁਨਰ ਨਾਲ਼ ਚੱਲ ਰਹੇ ਜੋ ਕਿ ਇੰਟਰਨੈੱਟ 'ਤੇ ਖੜੀ ਹੈ ਜਿੰਨੇ ਵੀ ਕੰਮ ਹੈ ਸਾਰੇ ਹੀ ਔਨਲਾਈਨ ਹੈ ਬਿਜਨਸ ਕਰਨਾ ਏ ਉਹਦਾ ਕੰਮ ਹੈ ਉਹ ਵੀ ਔਨਲਾਈਨ ਬੈਂਕ ਦਾ ਕੰਮ ਹੈ ਔਨਲਾਈਨ ਸਮਾਨ ਮੰਗਾਉਣਾ ਪਰਸਨਲ ਸਮਾਨ ਮੰਗਾਉਣਾ ਉਹ ਵੀ ਔਨਲਾਈਨ ਹੈ ਬੱਚਿਆਂ ਦੀ ਫੀਸ ਹੈ ਔਨਲਾਈਨ ਹੈ ਪੜ੍ਹਾਈ ਉਹ ਵੀ ਔਨਲਾਈਨ ਪੂਰੀ ਦੀ ਪੂਰੀ ਦੁਨੀਆਂ ਹੁਣ ਇੰਟਰਨੈਟ 'ਤੇ ਹੀ ਖੜ੍ਹੀ ਹੈ ਜਿਸ ਦੇ ਕਾਰਨ ਆਪਾਂ ਨੂੰ ਇਹ ਹੁਨਰ ਲੈਣ ਦੇ ਲਈ ਸਿੱਖਿਆ ਜ਼ਰੂਰੀ ਹੈ ਸਿੱਖਿਆ ਲਓਂਗੇ ਤਾਂ ਉਹਦੇ ਨਾਲ਼ ਫਿਰ ਆਪਾਂ ਕੰਪਿਊਟਰ ਵਗੈਰਾ ਸਿੱਖਾਂਗੇ ਕੰਪਿਊਟਰ ਸਿੱਖ ਕੇ ਹੀ ਆਪਾਂ ਇੰਟਰਨੈਟ ਤੱਕ ਪਹੁੰਚਾਂਗੇ ਜਿਹਦੇ ਨਾਲ਼ ਜਿੰਨਾ ਵੀ ਮਹੱਤਵਪੂਰਨ ਕੰਮ ਹੈ ਉਹ ਸਾਰੇ ਦਾ ਸਾਰਾ ਹੀ ਇੰਟਰਨੈਟ 'ਤੇ ਖੜ੍ਹਿਆ ਇਹਨੇ ਹੁਨਰ ਲੇ ਦੇ ਲਈ ਆਪਾਂ ਨੂੰ ਸਭ ਨੂੰ ਵੱਧ ਤੋਂ ਵੱਧ ਸਿੱਖਿਆ ਵੱਲ ਭੱਜਣਾ ਚਾਹੀਦਾ ਹੈ ਅਤੇ ਉਦੋਂ ਮੁੱਖ ਨਹੀਂ ਮੋੜਨਾ ਚਾਹੀਦਾ ਧੰਨਵਾਦ